ਹਾਂ ਮੈਂ ਕਿਤਾਬਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਮੈਗਜ਼ੀਨਸ ਅਤੇ ਅਖਬਾਰ ਪੜ੍ਹਦੀ ਹਾਂ ਅਖਬਾਰ ਦੇ ਵਿੱਚ ਦਾ ਟਰਬਿਊਨ ਜੋ ਕਿ ਇੰਗਲਿਸ਼ ਵਿੱਚ ਛਪਦਾ ਹੈ ਪੰਜਾਬੀ ਵਿੱਚ ਅਜੀਤ ਅਖਬਾਰ ਜੋ ਕਿ ਮੇਰੇ ਮਾਤਾ ਪਿਤਾ ਦੇ ਘਰ ਆਉਂਦਾ ਹੈ ਅਤੇ ਮੈਂ ਉਹ ਬਹੁਤ ਵਾਰ ਪੜ੍ਹਿਆ ਹੈ ਹਿੰਦੀ ਵਿੱਚ ਦੈਨਿਕ ਬਾਸਕਰ ਅਤੇ ਮੈਗਸੀਨਸ ਦੇ ਵਿੱਚ ਮੈਂ ਸਟਾਰਡਸਟ ਵਿਮਨ ਇਰਾ ਅਤੇ ਹਿੰਦੀ ਵਿੱਚ ਗ੍ਰਹਿ ਸ਼ੋਭਾ ਪੜ੍ਹਦੀ ਹਾਂ ਗ੍ਰਹਿ ਸ਼ੋਭਾ ਦੇ ਵਿੱਚ ਆਮ ਜਨਜੀਵਨ ਬਾਰੇ ਬਹੁਤ ਗੱਲਾਂ ਹੁੰਦੀਆਂ ਹਨ ਮੈਂ ਬਿਊਟੀ ਬਾਰੇ ਟਿਪਸ ਹੁੰਦੇ ਹਨ ਖਾਣਾ ਬਣਾਉਣ ਦੇ ਬਾਰੇ ਟਿਪਸ ਹੁੰਦੇ ਹਨ ਸਰਦੀਆਂ ਦੇ ਵਿੱਚ ਪਸ਼ਮ ਦੇ ਚੀਜ਼ਾਂ ਬਣਾਉਣ ਬਾਰੇ ਉਹਦੇ ਵਿੱਚ ਬਹੁਤ ਗੱਲਾਂ ਦੇਖਣ ਨੂੰ ਮਿਲਦੀਆਂ ਹਨ ਸਟਾਰਡਸਟ ਦੇ ਵਿੱਚ ਤੁਸੀਂ ਅੱਜ ਕੱਲ੍ਹ ਜਿਹੜੇ ਫਿਲਮੀ ਸਿਤਾਰੇ ਨੇ ਉਹਨਾਂ ਦੇ ਜੀਵਨ ਬਾਰੇ ਪਤਾ ਲੱਗਦਾ ਹੈ ਵਿਮਨ ਇਰਾ ਦੇ ਵਿੱਚ ਅਸੀਂ ਅੱਜ ਕੱਲ੍ਹ ਦੀਆਂ ਔਰਤਾਂ ਬਾਰੇ ਪਤਾ ਕਰਦੇ ਹਾਂ ਗਿਆਨ ਪ੍ਰਾਪਤ ਕਰਦੇ ਹਾਂ ਕਿ ਔਰਤਾਂ ਕਿਸ ਪੀੜ੍ਹੀ ਦੇ ਵਿੱਚ ਕੀ ਕੁਛ ਮਤਲਬ ਅੱਗੇ ਆ ਕੇ ਕਰ ਰਹੀਆਂ ਹਨ